ਪੰਜਾਬ ਦੇ ਵਿੱਚ ਲੋਕ ਕਾਫ਼ੀ ਵਹਿਮਾਂ ਭਰਮਾਂ ਦੇ ਵਿੱਚ ਵਿਸ਼ਵਾਸ ਰੱਖਦੇ ਹਨ ਜਿਵੇਂ ਕਿ ਅਸੀਂ ਜਦੋਂ ਘਰੋਂ ਨਿਕਲਦੇ ਹਾਂ ਤਾਂ ਘਰ ਤੋਂ ਨਿਕਲਦੇ ਸਾਰ ਰਸਤੇ ਵਿੱਚ ਕੋਈ ਖਾਲੀ ਟੋਕਰਾ ਜਾਂ ਖਾਲੀ ਤਸਲਾ ਆਦਿ ਲੈ ਕੇ ਮਿਲ ਜਾਵੇ ਤਾਂ ਉਸਦਾ ਵਹਿਮ ਕੀਤਾ ਜਾਂਦਾ ਘਰ ਤੋਂ ਨਿਕਲ਼ਦੇ ਸਾਰ ਕੋਈ ਛਿੱਕ ਮਾਰਦੇ ਤਾਂ ਉਹਦਾ ਵੀ ਵਹਿਮ ਕੀਤਾ ਜਾਂਦਾ ਤੀਜੇ ਨੰਬਰ 'ਤੇ ਗੱਲ ਕਰੀਏ ਕਿ ਰਸਤੇ ਦੇ ਵਿੱਚ ਜੇਕਰ ਬਿੱਲੀ ਸਾਡਾ ਰਸਤਾ ਕੱਟ ਜਾਵੇ ਤਾਂ ਉਹਦਾ ਵੀ ਇੱਕ ਵਹਿਮ ਕੀਤਾ ਜਾਂਦਾ ਏ ਚੌਥੇ ਨੰਬਰ 'ਤੇ ਚੁਰਸਤੇ ਦੇ ਵਿੱਚ ਲੰਘਣਾ ਵੀ ਸਾਡੇ ਵੀ ਇੱਕ ਵਹਿਮ ਮੰਨਿਆ ਜਾਂਦਾ ਸੀ ਕਿ ਇਸ ਸਮੇਂ ਇਸ ਰਸਤੇ ਨੂੰ ਨਹੀਂ ਨਿਕਲਣਾ ਅਤੇ ਇਸ ਕਰਕੇ ਲੋਕ ਦੇ ਅੰਦਰ ਵਹਿਮ ਭਰਮ ਬਹੁਤ ਮਜ਼ਬੂਤ ਪੱਧਰ 'ਤੇ ਵਿਸ਼ਵਾਸ ਰੱਖਦੇ